ਮੈਂ ਰਾਜੇਸ਼ ਕੁਮਾਰ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹਾਂ ਮੈਂ ਆਪਣੀ ਭੈਣ ਧੀ ਅਤੇ ਦੋਸਤ ਨੂੰ ਇਹ ਸਿੱਖਿਆ ਦੇਵਾਂਗਾ ਕਿ ਤੁਸੀਂ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰੋ ਕਿਉਂਕਿ ਇਸ ਸਮੇਂ ਸਾਨੂੰ ਸਿੱਖਿਆ ਦੀ ਬੜੀ ਹੀ ਜ਼ਰੂਰਤ ਹੈ ਅਸੀਂ ਵੱਧ ਤੋਂ ਵੱਧ ਸਿੱਖਿਅਤ ਹੋਵਾਂਗੇ ਤਾਂ ਹੀ ਅਸੀਂ ਆਪਣੇ ਬੱਚਿਆਂ ਆਪਣੇ ਸਕੂਲ ਦੇ ਵਿਚ ਇਹ ਗੱਲ ਕਹਿ ਸਕਦੇ ਹਾਂ ਕਿ ਸਮਾਜ ਨੂੰ ਇਹ ਸੇਧ ਦੇ ਸਕਦੇ ਹਾਂ ਕਿ ਹਰ ਬਚ ਬੰਦੇ ਨੂੰ ਆਪਣੇ ਪੈਰਾਂ ਉੱਤੇ ਖੜ੍ਹੇ ਹੋਣਾ ਚਾਹੀਦਾ ਹੈ ਤਾਂ ਕਿ ਸਮੇਂ ਸਿਰ ਉਸ ਨੂੰ ਸਮੇਂ ਸਮੇਂ 'ਤੇ ਉਸ ਨੂੰ ਉਹ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰ ਸਕੇ ਧੰਨਵਾਦ